ਪਿੱਠ ਦੇ ਦਰਦ ਨੂੰ ਠੀਕ ਕਰਨ ਦੇ ਲਈ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਵਰਤੇ ਜਾਣ ਵਾਲੇ ਨੁਕਤੇ ਐ ਹਨ ਜਿਵੇਂ ਕਿ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਆਪਣੀ ਕਮਰ ਦੇ ਉੱਪਰ ਖੜ੍ਹਾ ਕੇ ਉਹਨਾਂ ਨਾਲ ਲਤੜਾਈ ਕੀਤੀ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਸਰ੍ਹੋਂ ਦਾ ਗਰਮ ਤੇਲ ਕਰਕੇ ਉਸ ਦੇ ਨਾਲ ਸ ਪਿੱਠ ਦੇ ਦਰਦ ਨੂੰ ਮਸਾਜ ਨਾਲ ਠੀਕ ਕੀਤਾ ਜਾਂਦਾ ਹੈ ਫਿਰ ਜਿਵੇਂ ਆਪਣੇ ਪੁਰਾਣੇ ਰਜਾਈਆਂ ਗਦੈਲਿਆਂ ਦੇ ਵਿੱਚੋਂ ਨਿਕਲਣ ਵਾਲੇ ਲੋਗੜ ਨੂੰ ਥੋੜ੍ਹਾ ਗਰਮ ਕਰਕੇ ਉਸ ਦੇ ਨਾਲ ਪਿੱਠ ਨੂੰ ਸਿਕਾਈ ਕੀਤੀ ਜਾਂਦੀ ਹੈ ਜਿਸ ਦੇ ਨਾਲ ਪਿੱਠ ਦਰਦ ਵਿੱਚ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ ਉਸ ਤੋਂ ਬਾਅਦ ਗਰਮ ਪਾਣੀ ਦੇ ਵਿੱਚ ਫੜਕੜੀ ਅਤੇ ਨਮਕ ਪਾ ਕੇ ਉਸ ਦੀ ਟਕੋਰ ਕਰਨ ਨਾਲ ਕਮਰ ਦਰਦ ਦੇ ਵਿੱਚ ਕਾਫੀ ਆਰਾਮ ਮਿਲਦਾ ਹੈ ਖਾਸ ਕਰਕੇ ਐਕਸਰਸਾਈਜ਼ ਜਿਵੇਂ ਕਿ ਲੱਤਾਂ ਨੂੰ ਬੈਂਡ ਕਰਕੇ ਵਜਰ ਆਸ਼ਣ ਦੇ ਵਿੱਚ ਬੈਠਣਾ ਇਹ ਨੁਕਤੇ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਕਮਰ ਦਰਦ ਲਈ ਵਰਤੇ ਜਾਂਦੇ ਹਨ ਜਾਂ ਇੱਕ ਜਾਂ ਦੂਜੇ ਦੋ ਬੰਦੇ ਆਪਸ ਦੇ ਵਿੱਚ ਆਪਣੀਆਂ ਕਮਰਾਂ ਇੱਕ ਦੂਜੇ ਨਾਲ ਜੋੜ ਕੇ ਉਹਨਾਂ ਦੇ ਕਮਰ ਦਰਦ ਵਾਲੇ ਬੰਦੇ ਦੇ ਹੱਥਾਂ ਨੂੰ ਫੜ ਕੇ ਅਤੇ ਉਹਨੂੰ ਆਪਣੀ ਕਮਰ ਨੂੰ ਝੁਕਾ ਕੇ ਉਹਨੂੰ ਖਿੱਚਿਆ ਜਾਂਦਾ ਹੈ ਜਿਸ ਦੇ ਨਾਲ ਕਮਰ ਦਰਦ ਤੋਂ ਬੋ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਕਿਉਂਕਿ ਜਿਹੜਾ ਖਿਚਾਵ ਮਸਲਸ ਦੇ ਵਿੱਚ ਆਇਆ ਹੁੰਦਾ ਹੈ ਇਸ ਨਾਲ ਉਹ ਰਿਲੀਜ਼ ਹੋ ਜਾਂਦਾ ਹੈ ਅਤੇ ਕਮਰ ਦਰਦ ਦੇ ਵਿੱਚ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ